ਮੈਂ ਸਿੱਖ ਧਰਮ ਨੂੰ ਮੰਨਦੀ ਹਾਂ ਜਿਸ ਵਿੱਚ ਆਪ ਸਭ ਨੂੰ ਪਤਾ ਹੀ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੇ ਪਹਿਲੇ ਗੁਰੂ ਹੋਏ ਹਨ ਜਿਹਨਾਂ ਨੇ ਆਪਾਂ ਨੂੰ ਸ਼ਾਂਤੀ ਦਾ ਸੰਦੇਸ਼ ਚਾਰੇ ਪਾਸੇ ਮਤਲਬ ਉਦਾਸੀਆਂ ਦੇ ਰਾਹੀ ਲੋਕਾਂ ਤੱਕ ਜਾ ਕੇ ਪਹੁੰਚਾਇਆ ਉਸ ਤੋਂ ਅੱਗੇ ਵੀ ਗੁਰੂਆਂ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਪਰ ਜਦ ਜ਼ੁਲਮ ਦੀ ਹੱਦ ਵੱਧ ਗਈ ਤਾਂ ਆਪਣੇ ਗੁਰੂਆਂ ਨੂੰ ਹਥਿਆਰ ਵੀ ਚੱਕਣੇ ਪਏ ਉਹਨਾਂ ਨੂੰ ਜੰਗ ਯੁੱਧ ਵੀ ਕਰਨੇ ਪਏ ਔਰ ਇਸ ਤਰ੍ਹਾਂ ਸਿੱਖ ਧਰਮ ਨੇ ਆਪਣੇ ਧਰਮ ਦੇ ਨਾਲ ਨਾਲ ਦੂਜੇ ਧਰਮਾਂ ਦੀ ਵੀ ਰੱਖਿਆ ਕਰੀ ਹਿੰਦੂ ਧਰਮ ਦੀ ਰੱਖਿਆ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਗੁਰੂ ਜਿਹੜੇ ਦੇਹਧਾਰੀ ਗੁਰੂ ਹੈ ਇਸ ਪ੍ਰਥਾ ਨੂੰ ਖਤਮ ਕਰਦੇ ਹੋਏ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਆਪ ਵੀ ਉਹਨਾਂ ਤੋਂ ਅੰਮ੍ਰਿਤ ਛਕਿਆ ਵਿਸਾਖੀ ਵਾਲੇ ਦਿਨ ਉਹਨਾਂ ਨੇ ਸਾਰਿਆਂ ਨੂੰ ਇਹ ਅੰਮ੍ਰਿਤ ਛਕਾਇਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕਰੀ ਜਿਸ ਦੇ ਲੜ ਉਹਨਾਂ ਨੇ ਸਿੱਖ ਧਰਮ ਨੂੰ ਲਾਇਆ ਅਤੇ ਆਪਾਂ ਸਾਰਿਆਂ ਨੂੰ ਉਸ ਤੋਂ ਬਾਅਦ ਉਹ ਜੋਤੀ ਜੋਤ ਵੀ ਸਮਾ ਗਏ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਅਤੇ ਇਸ ਤੋਂ ਬਾਅਦ ਉਹਨਾਂ ਨੇ ਜੋ ਵੀ ਆਪਾਂ ਨੂੰ ਸੰਦੇਸ਼ ਜੋ ਵੀ ਆਪਾਂ ਨੂੰ ਅੱਗੇ ਸਿੱਖ ਧਰਮ ਨੂੰ ਚਲਾਉਣ ਵਾਸਤੇ ਦੱਸਿਆ ਹੈ ਉਹ ਸਾਰਾ ਕੁਛ ਗੁਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਆਪਾਂ ਨੂੰ ਸਿੱਖ ਧਰਮ ਨੂੰ ਉਸੇ 'ਤੇ ਚੱਲਣ ਦਾ ਸੰਦੇਸ਼ ਦੇ ਕੇ ਉਹ ਆਪ ਹਮੇਸ਼ਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ ਗੁਰੂ ਬਣਾ ਕੇ ਆਪਣੇ ਵਾਸਤੇ ਗਏ ਹਨ ਜੋ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦਸਤੇ ਰਸਤੇ 'ਤੇ ਹੀ ਚੱਲਣਾ ਚਾਹੀਦਾ ਹੈ